ਛੇ ਜਨਵਰੀ ਉੱਨੀ ਸੌ ਚੁਰਾਨਵੇਂ ਸੱਤ ਮਾਰਚ ਦੋ ਹਜ਼ਾਰ ਦੋ ਬਾਰਾਂ ਦਸੰਬਰ ਦੋ ਹਜ਼ਾਰ ਅੱਠ ਚੌਦਾਂ ਅਪ੍ਰੈਲ ਦੋ ਹਜ਼ਾਰ ਬਾਈ ਅਠਾਰਾਂ ਜੁਲਾਈ ਦੋ ਹਜ਼ਾਰ ਤੇਈ